ਹੈਲੋ ਭਾਈ ਫਲਿੱਪਕਾਡ ਤੋਂ ਬੋਲਦੇ ਪਏ ਹਾਂਜੀ ਭਾਅ ਜੀ ਰਿਵਿਊ ਦੇਣਾ ਸੀ ਹਾਂਜੀ ਮੈਂ ਆਈਫੋਨ ਮੰਗਵਾਇਆ ਸੀ ਤੁਹਾਡੇ ਤੋਂ ਲਾਸਟ ਮੰਥ ਹਾਂਜੀ ਅਤੇ ਬੜਾ ਵਧੀਆ ਪ੍ਰੋਡਕਟ ਨਿਕਲਿਆ ਤੁਹਾਡਾ ਬਲੂ ਕਲਰ ਦਾ ਆਈਫੋਨ ਸੀਗਾ ਮੇਰਾ ਅਤੇ ਚਾਰ ਚੌਂਹਠ ਸੀਗਾ ਵਧੀਆ ਸੀ ਆਈਫੋਨ ਥਰਟੀਨ ਮੰਗਵਾਇਆ ਸੀ ਮੈਂ ਵਧੀਆ ਟਾਈਮ 'ਤੇ ਤੁਸੀਂ ਡਿਲੀਵਰੀ ਕਰਤੀ ਸੀਗੀ ਵਧੀਆ ਸੀਗਾ ਮਤਲਬ ਅਜੇ ਤੱਕ ਬਹੁਤ ਵਧੀਆ ਚੱਲਦਾ ਪਿਆ ਕਈ ਵਾਰੀ ਕੀ ਹੁੰਦਾ ਵਾ ਕਿ ਕਲੋਨ ਵਗੈਰਾ ਆ ਜਾਂਦੇ ਔਨਲਾਈਨ ਪਰ ਤੁਹਾਡਾ ਪ੍ਰੋਡਕਟ ਬਹੁਤ ਵਧੀਆ ਸੀਗਾ ਇੱਥੇ ਓਪਨ ਬੋਕਸ ਡਿਲੀਵਰੀ ਹੀ ਬਹੁਤ ਹੈਲਪ ਮਿਲਦੀ ਆ ਓਪਨ ਬੋਕਸ ਡਿਲੀਵਰੀ ਨਾਲ ਫਰੋਡ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਨੇ ਹਾਂਜੀ ਰੀਜਨੇਬਲ ਪ੍ਰਾਈਸ 'ਤੇ ਮਿਲ ਗਿਆ ਸੀਗਾ ਮੈਂ ਸੇਲ ਤੋਂ ਮੰਗਵਾਇਆ ਸੀਗਾ ਹਾਂਜੀ ਹਾਂਜੀ ਹਾਂਜੀ ਅਤੇ ਥੋੜ੍ਹੇ ਪੈਸੇ ਜੁੜੇ ਹੋਏ ਸੀਗੇ ਥੋੜ੍ਹੇ ਘਰੋਂ ਲੈ ਲਏ ਅਤੇ ਵਧੀਆ ਆਈਫੋਨ ਮਿਲ ਗਿਆ ਸੀਗਾ ਮੈਨੂੰ ਹਾਂਜੀ ਬਹੁਤ ਬਹੁਤ ਥੈਂਕਸ ਆ ਤੁਹਾਡਾ ਤੁਸੀਂ ਆਈਫੋਨ ਮੈਨੂੰ ਦੇ ਤਾ ਮੇਰਾ ਬਹੁਤ ਵਧੀਆ ਮਤਲਬ ਮ ਸੁਪਨਾ ਸੀਗਾ ਕਿ ਆਈਫੋਨ ਲਵਾਂ ਮੈਂ ਹਾਂਜੀ ਸਿਰਫ ਹਾਂਜੀ ਇਹੀ ਰਿਵਿਊ ਦੇਣ ਲਈ ਮੈਂ ਫੋਨ ਕੀਤਾ ਸੀਗਾ ਹਾਂਜੀ ਹਾਂਜੀ ਹਾਂਜੀ ਅਤੇ ਐਂ ਬਹੁਤ ਵਧੀਆ ਚੱਲਦਾ ਫੋਨ ਕਲੋਨ ਨਹੀਂ ਹੈਗਾ ਕੋਈ ਸੈਕਿੰਡ ਹੈਂਡ ਨਹੀਂ ਹੈਗਾ ਰੀਫਰਮਿਸ਼ ਨਹੀਂ ਹੈਗਾ ਹਾਂਜੀ ਡਿਲੀਵਰੀ ਬੁਆਏ ਬਹੁਤ ਵਧੀਆ ਸੀਗਾ ਤੁਹਾਡੀ ਬਹੁਤ ਵਧੀਆ ਸਰਵਿਸ ਹੁੰਦੀ ਆ ਮੈਂ ਬਹੁਤ ਪ੍ਰੋਡਕਟ ਮੰਗਵਾਉਂਦੀ ਤੁਹਾਡੇ ਤੋਂ ਪਰ ਆਈਫੋਨ ਨੇ ਤਾਂ ਦਿਲ ਖੁਸ਼ ਕਰਤਾ ਸੀਗਾ ਹਾਂਜੀ ਥੈਂਕ ਯੂ ਸੋ ਮਚ ਸਰ ਤੁਸੀਂ ਬਹੁਤ ਵਧੀਆ ਸਰਵਿਸ ਦਿੱਤੀ ਉਹਦੇ ਲਈ ਵੀ ਤੁਹਾਡਾ ਡਿਲੀਵਰੀ ਬੁਆਏ ਵੀ ਬਹੁਤ ਵਧੀਆ ਸੀਗਾ ਥੈਂਕ ਯੂ ਸੋ ਮੱਚ